ਸਟੇਸ਼ਨ ਮਾਸਟਰ ਜੀ ਮੈਂ ਹੁਣੇ ਹਾਲੇ ਦਿਨਾਂ ਦੇ ਵਿੱਚ ਰੇਲ ਯਾਤਰਾ ਕਰਕੇ ਆਈ ਅਤੇ ਮੈਨੂੰ ਕਾਫੀ ਅੱਛਾ ਲੱਗਿਆ ਉਥੋਂ ਦੀ ਸਫਾਈ ਅਤੇ ਉਥੋਂ ਦੇ ਸੇਵਾਦਾਰ ਅਤੇ ਟੀਟੀ ਸਾਹਿਬ ਵੀ ਜਿਨਾ ਜੋ ਕੁਸ਼ਚਨ ਮੈਨੂੰ ਪੁੱਛੇ ਜਾਂ ਮੈਂ ਉਹਨਾਂ ਦੇ ਕੁਸ਼ਚਨ ਦਾ ਜਵਾਬ ਬੜਾ ਅੱਛਾ ਦਿੱਤਾ ਉਹਨਾਂ ਨੇ ਮੈਨੂੰ ਬੜਾ ਅੱਛਾ ਟਰੀਟ ਕੀਤਾ ਅਤੇ ਸੇਵਾਦਾਰ ਵੀ ਬਹੁਤ ਅੱਛੇ ਹਰ ਚੀਜ਼ ਲਈ ਅੱਗੇ ਤੋਂ ਅੱਗੇ ਕਾਫੀ ਸੇਵਾ ਲਈ ਅੱਛੇ ਕਰ ਰਹੇ ਸੀ ਮੈਨੂੰ ਬਹੁਤ ਅੱਛਾ ਲੱਗਿਆ ਸੋ ਮੈਂ ਤੁਹਾਡੀ ਬਹੁਤ ਸ਼ੁਕਰ ਗੁਜ਼ਾਰ ਹਾਂ ਇਸ ਲਈ ਸੋ ਤੁਸੀਂ ਅੱਗੇ ਵੀ ਆਪਣੀ ਸੇਵਾ ਇਸੇ ਤਰ੍ਹਾਂ ਜਾਰੀ ਕੀ ਕੀਤੀ ਰੱਖਿਓ